ਹੈਲੋ ਗੁਡ ਮੋਰਨਿੰਗ ਹਾਂਜੀ ਹਾਂਜੀ ਬੇਟਾ ਓਕੇ ਹਾਂਜੀ ਹਾਂ ਹਾਂ ਬੇਟਾ ਤੁਸੀਂ ਐੱਮ ਏ ਨੂੰ ਜੋਗ੍ਰਾਫੀ ਕਰ ਸਕਦੇ ਓਂ ਅਤੇ ਉਸ ਤੋਂ ਬਾਅਦ ਫਿਰ ਤੁਹਾਡਾ ਕੀ ਗੋਲ ਹੈ ਏਮ ਕੀ ਏ ਲਾਈਫ ਦਾ ਤਾਂ ਮਤਲਬ ਟੀਚਿੰਗ ਸਟ੍ਰੀਮ ਦੇ ਵਿੱਚ ਜਾਣਾ ਜਾਂ ਕਿੱਦਾਂ ਹਾਂ ਹਾਂ ਫਿਰ ਤੁਹਾਡੇ ਲਈ ਗੁੱਡ ਹੈ ਜੇ ਤੁਸੀਂ ਜੋਗ੍ਰਾਫੀ ਦੇ ਵਿੱਚ ਮਾਸਟਰਸ ਕਰ ਸਕਦੇ ਓਂ ਉਸ ਤੋਂ ਬਾਅਦ ਤੁਸੀਂ ਯੂ ਜੀ ਸੀ ਨੈਟ ਹੈ ਜਿਹੜਾ ਉਹ ਜੋਗ੍ਰਾਫੀ ਸਬਜੈਕਟ ਦੇ ਵਿੱਚ ਹੀ ਕਰ ਸਕਦੇ ਓਂ ਅਤੇ ਤੁਹਾਡੇ ਲਈ ਓਪਸ਼ਨਸ ਹੋ ਜਾਂਦੇ ਨੇ ਕਿ ਤੁਸੀਂ ਪ੍ਰੋਫੈਸਰ ਲਾਈਨ ਦੇ ਵਿੱਚ ਜਾ ਸਕਦੇ ਓਂ ਠੀਕ ਹੈ ਵੈਸੇ ਤੁਹਾਡੇ ਲਈ ਦੂਜਾ ਓਪਸ਼ਨ ਹੋ ਸਕਦਾ ਕਿ ਤੁਸੀਂ ਬੀ ਐਡ ਵੀ ਕਰਦੇ ਹੋ ਜੇ ਤੁਸੀਂ ਸਕੂਲ ਲੈਵਲ ਦੇ ਉੱਤੇ ਟੀਚਰ ਹੈ ਜਿਹੜਾ ਉਹ ਬਣਨਾ ਚਾਹੁੰਦੇ ਓਂ ਦੋਵੇਂ ਓਪਸ਼ਨ ਹੈ ਤੁਹਾਡੇ ਲਈ ਓਪਨ ਹੋ ਸਕਦੇ ਨੇ ਫਿਰ ਤੁਹਾਡੀ ਕਹਿ ਲਉ ਸਿਕਸਟੀ ਤੋਂ ਅਬਵ ਮਾਰਕਸ ਚਾਹੀਦੇ ਨੇ ਅਲੀਜੀਬਿਲਟੀ 'ਤੇ ਇਹੀ ਹੈ ਉਸ ਤੋਂ ਇਲਾਵਾ ਜੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਫਿਰ ਆਪਣਾ ਉਸ ਤੋਂ ਪਹਿਲਾਂ ਨਾ ਇੱਕ ਪੇਪਰ ਹੋਏਗਾ ਅਲੀਜੀਬਿਲਟੀ ਦੇ ਲਈ ਉਹ ਤੁਹਾਨੂੰ ਕੁਆਲੀਫਾਈ ਕਰਨਾ ਪਵੇਗਾ ਉਹਦੇ ਵਿੱਚ ਤੁਹਾਡੇ ਸੈਵਨਟੀ ਪ੍ਰਸੈਂਟ ਮਾਕਸ ਆਉਣੇ ਚਾਹੀਦੇ ਨੇ ਅਤੇ ਤੁਹਾਨੂੰ ਇਹ ਜਿਹੜੀ ਉਹ ਯੂਨੀਵਰਸਿਟੀ ਦੇ ਵਿੱਚ ਸੀਟ ਹੈ ਮਿਲ ਸਕਦੀ ਹੈ ਠੀਕ ਹੈ ਹਾਂਜੀ ਅਤੇ ਨਾ ਇਹ ਜਿਹੜੀ ਤੁਹਾਡਾ ਪੇਪਰ ਹੈ ਉਹਦੀ ਲਾਸਟ ਡੇਟ ਹੈ ਜਿਹੜੀ ਉਹ ਟਵੈਟੀ ਫਿਫਥ ਜਨਵਰੀ ਹੈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਦਾ ਫੋਰਮ ਹੈ ਫਿਲ ਕਰ ਦਿਓ ਠੀਕ ਹੈ ਠੀਕ ਹੈ ਓਕੇ ਬੇਟਾ ਥੈਂਕ ਯੂ ਓਕੇ